ਵੈਸੇ ਤਾਂ ਉਹ ਭਾਰਤ ਦੇ ਵੱਖ ਵੱਖ ਕੋਨਿਆਂ ਵਿੱਚ ਭੋਜਨ ਦਾ ਅੰਤਰ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਜੇਕਰ ਆਪਾਂ ਗੱਲ ਕਰੀਏ ਉੱਤਰ ਅਤੇ ਦੱਖਣੀ ਭਾਰਤ ਦੇ ਭੋਜਨ ਵਿੱਚ ਬਹੁਤ ਜ਼ਿਆਦਾ ਅੰਤਰ ਦੇਖਣ ਨੂੰ ਮਿਲਿਆ ਹੈ ਪਹਿਲਾ ਮਹੱਤਵਪੂਰਨ ਅੰਤਰ ਉਹਨਾਂ ਨੂੰ ਬਣਾਉਣ ਵਿੱਚ ਉਪਯੋਗ ਹੋਣ ਵਾਲੀ ਸਮੱਗਰੀ ਦਾ ਹੈ ਜਿਵੇਂ ਉੱਤਰੀ ਭਾਰਤ ਵਿੱਚ ਦਹੀਂ ਕਰੀਮ ਘੀ ਅਤੇ ਪਨੀਰ ਜਿਹੇ ਡੇਅਰੀ ਉਤਪਾਦਾਂ 'ਤੇ ਬਹੁਤ ਨਿਰਭਰ ਕਰਦੇ ਹਨ ਉੱਥੇ ਹੀ ਦੂਜੇ ਪਾਸੇ ਦੱਖਣੀ ਭਾਰਤ ਵਿੱਚ ਸਬਜ਼ੀਆਂ ਦਾਲ ਚਾਵਲ ਅਤੇ ਨਾਰੀਅਲ ਦਾ ਦੁੱਧ ਅਧਿਕ ਪ੍ਰਯੋਗ ਹੁੰਦਾ ਹੈ ਇਸ ਤਰ੍ਹਾਂ ਉੱਤਰੀ ਭਾਰਤ ਵਿੱਚ ਬਹੁਤ ਅਧਿਕ ਮਾਤਰਾ ਵਿੱਚ ਕਣਕ ਉਗਾਈ ਜਾਂਦੀ ਹੈ ਇਸ ਲਈ ਕਣਕ ਦੀ ਰੋਟੀ ਬਰੈਡ ਇੱਥੇ ਆਮ ਹੈ ਜਦਕਿ ਦੱਖਣੀ ਭਾਰਤ ਵਿੱਚ ਚੌਲ ਅਤੇ ਦਾਲ ਦਾ ਬੋਲਬਾਲਾ ਹੈ ਸੋ ਉੱਥੇ ਜ਼ਿਆਦਾ ਆਪਾਂ ਮਾਤਰਾ ਵਿੱਚ ਚੌਲ ਅਤੇ ਦਾਲ ਖਾਣ ਵਾਲੇ ਲੋਕ ਜ਼ਿਆਦਾ ਨੇ ਮਸਾਲੇਦਾਰ ਚੀਜ਼ਾਂ ਅਤੇ ਉੱਥੇ ਮਾਸ ਮੱਛੀ ਨੂੰ ਵੀ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ ਜੇਕਰ ਮੈਂ ਗੱਲ ਕਰਾਂ ਆਪਣੀ ਤਾਂ ਜਦੋਂ ਵੀ ਮੇਰੇ ਘਰ ਕੋਈ ਮਹਿਮਾਨ ਆਉਂਦਾ ਤਾਂ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਮੈਂ ਇੱਕ ਸਪੈਸ਼ਲ ਥਾਲੀ ਜਿਵੇਂ ਮੈਂ ਕਹਿ ਸਕਦੇ ਹਾਂ ਕਿ ਉੱਤਰੀ ਭਾਰਤ ਦੀ ਥਾਲੀ ਨੂੰ ਜ਼ਿਆਦਾ ਮਾਨਤਾ ਦਿੰਦੀ ਹਾਂ ਜਿਹਦੇ ਵਿੱਚ ਸਾਰੀਆਂ ਸਬਜ਼ੀਆਂ ਪਨੀਰ ਦੀ ਸਬਜ਼ੀ ਦਾਲ ਅਤੇ ਇੱਕ ਕਣਕ ਦੀ ਰੋਟੀ ਤਾਂ ਇਹ ਸਾਰੀਆਂ ਚੀਜ਼ਾਂ ਮੇਰੀ ਥਾਲੀ ਦੇ ਵਿੱਚ ਹੁੰਦੀਆਂ ਹੀ ਹੁੰਦੀਆਂ ਨੇ ਮੌਜੂਦ ਸੋ ਜਦੋਂ ਵੀ ਕੋਈ ਮਹਿਮਾਨ ਆਉਂਦਾ ਤਾਂ ਮੈਂ ਉੱਤਰੀ ਭਾਰਤ ਦੀ ਥਾਲੀ ਨੂੰ ਜ਼ਿਆਦਾ ਮਾਨਤਾ ਦਿੰਦੀ ਹਾਂ